ਖੇਡਾਂ ਦੇ ਪੱਧਰਾਂ ਤੋਂ ਜਿਹੜੇ ਖੇਡਾਂ ਹੁੰਦੀਆਂ ਉਹ ਲੋਕਾਂ ਦਾ ਸਟ੍ਰੈੱਸ ਦੂਰ ਕਰ ਦਿੰਦੀਆਂ ਅਤੇ ਉਹਨਾਂ ਨੂੰ ਆਨੰਦਦਾਈ ਬਣਾਉਂਦੀਆਂ ਉਹ ਬਣਾਉਂਦੀਆਂ ਐਵੇਂ ਆ ਵੀ ਪ੍ਰਦਾਨ ਕਰਦੀਆਂ ਆਪਾਂ ਨੂੰ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਵੀ ਵਿਅਕਤੀ ਕੋਈ ਵੀ ਦਿਮਾਗੀ ਆਪਣੀ ਟੈਨਸ਼ਨ ਦੇ ਵਿੱਚ ਹੁੰਦਾ ਕੋਈ ਦਿਮਾਗੀ ਪਰੇਸ਼ਾਨੀ ਦੇ ਵਿੱਚ ਹੁੰਦਾ ਜਿਸ ਕਰਕੇ ਉਹ ਕੋਈ ਖੇਡ ਖੇਡਣ ਲੱਗ ਜਾਂਦਾ ਅਤੇ ਉਹ ਜਿਵੇਂ ਕਿ ਕੋਈ ਬੰਦਾ ਆਪਦੀ ਮੰਨ ਲਓ ਚਿੜੀ ਛਿੱਕਾ ਖੇਡਣ ਲੱਗ ਗਿਆ ਚਿੜੀ ਬੱਲਾ ਕਹਿ ਦਿੰਦੇ ਆਪਾਂ ਇਹਨੂੰ ਜਿਹੜੀ ਛਿੱਕਾ ਖੇਡਣ ਲੱਗ ਗਿਆ ਤਾਂ ਉਹ ਘੰਟਾ ਦੋ ਘੰਟੇ ਆਪਦੇ ਉਹਦੇ 'ਚ ਲਾਊਗਾ ਜਾਂ ਫੜਨ ਫੜੀ 'ਚ ਲਾ ਲਊ ਹੋਰ ਬਾਂਦਰ ਕਿੱਲਾ ਹੋਰ ਕੋਈ ਵੀ ਨਾਰਮਲ ਖੇਡ ਲਾ ਲਉ ਜਿਹੜੀ ਦੀ ਜਿਹਦੇ ਨਾਲ ਸਰੀਰਕ ਦੀ ਆਪਣੀ ਦੀ ਵੀ ਮੁਰੰਮਤ ਹੋਵੇ ਅਤੇ ਉਹ ਬੰਦਾ ਉਹ ਖੇਡ ਦੇ ਵਿੱਚ ਇਨਵੋਲਵ ਹੋ ਜਾਂਦਾ ਵੀ ਉਹ ਖੇਡ ਦੇ ਵਿੱਚ ਧੱਸ ਜਾਂਦਾ ਜਿਸ ਨਾਲ ਉਹਦੀਆਂ ਜਿਹੜੀਆਂ ਦਿਮਾਗੀ ਟੈਨਸ਼ਨਾਂ ਉਹਦਾ ਸਟ੍ਰੈੱਸ ਆ ਸਾਰਾ ਕੁਛ ਦੂਰ ਹੋ ਜਾਂਦਾ ਉਹਦਾ ਡਿਪਰੈਸ਼ਨ ਸਭ ਕੁਛ ਦੂਰ ਹੋ ਜਾਂਦਾ ਅਤੇ ਉਹ ਆਪਦੇ ਆਪ ਨੂੰ ਫਰੈਸ਼ ਫੀਲ ਕਰਦਾ ਵੀ ਆਨੰਦਦਾਇਕ ਫੀਲ ਕਰਦਾ ਜਿਹਦੇ ਨਾਲ ਜਿਹੜੀਆਂ ਖੇਡਾਂ ਉਹਦੇ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਉਹ ਮਨੁੱਖ ਦੀ ਆਨੰਦਦਾਇਕਤਾ ਦੇ ਵਿੱਚ ਅਤੇ ਜਿਹੜਾ ਸਰੀਰ ਉਹਦਾ ਸੈੱਟ ਰਹਿੰਦਾ ਤੰਦਰੁਸਤ ਰਹਿੰਦਾ ਉਹ ਤਾਂ ਰਹਿੰਦਾ ਹੀ ਰਹਿੰਦਾ ਵੀ ਬਹੁਤ ਮਦਦ ਕਰਦੀਆਂ ਨੇ ਖੇਡਾਂ